ਵੈਸੇ ਅਗਰ ਤਕਨੋਲਜੀ ਦੀ ਗੱਲ ਕੀਤੀ ਜਾਵੇ ਤਾਂ ਤਕਨੋਲਜੀ ਅੱਜ ਦੇ ਟਾਇਮ ਬਹੁਤ ਹੀ ਜ਼ਿਆਦਾ ਵਿਕਸਿਤ ਹੋਈ ਹੈ ਜਿਵੇਂ ਕਿ ਪੁਰਾਣੇ ਟਾਇਮ ਦੇ ਵਿੱਚ ਨਾ ਤਾਂ ਕਿਸੇ ਦੇ ਕੋਲ ਕਿਸੇ ਨੇ ਨਾ ਸੋਚਿਆ ਸੀ ਕਿ ਆਉਣ ਵਾਲੇ ਟਾਇਮ 'ਚ ਸਾਡੇ ਕੋਲ ਟੱਚ ਫ਼ੋਨ ਹੋਣਗੇ ਪਹਿਲੀ ਗੱਲ ਤਾਂ ਫ਼ੋਨ ਦਾ ਹੀ ਨਹੀਂ ਕਿਸੇ ਨੇ ਸੋਚਿਆ ਸੀ ਜਦੋਂ ਆਪਣਾ ਪੁਰਾਣਾ ਟਾਇਮ ਸੀ ਇੰਡੀਆ ਦਾ ਅਤੇ ਆਉਣ ਹੌਲੀ ਹੌਲੀ ਜਿੱਦਾਂ ਜਿੱਦਾਂ ਟਾਇਮ ਬਦਲਦਾ ਗਿਆ ਪਹਿਲਾਂ ਬਟਨਾਂ ਵਾਲੇ ਫ਼ੋਨ ਆਏ ਬਟਨਾਂ ਵਾਲੇ ਫ਼ੋਨ ਅਤੇ ਬਾਅਦ ਫਿਰ ਹੌਲੀ ਹੌਲੀ ਫ਼ੋਨ ਜਿੱਦਾਂ ਅੱਗੇ ਅੱਗੇ ਗਰੋਥ ਹੁੰਦੀ ਗਈ ਅੱਜ ਸਾਡੇ ਕੋਲ ਕਿਸੇ ਟਾਇਮ ਬੰਦਾ ਛੋਟੇ ਫ਼ੋਨ ਲੈਣ ਨੂੰ ਤਰਸਦਾ ਹੁੰਦਾ ਸੀ ਅੱਜ ਹਰੇਕ ਇਨਸਾਨ ਦੇ ਕੋਲ ਬੜੇ ਬੜੇ ਫੋਨ ਹਨ ਅਗਰ ਆਪਾਂ ਹੁਣ ਦੂਜੀ ਗੱਲ ਕਰੀਏ ਟਕਨੋਲਜੀ ਦੀ ਜਿਵੇਂ ਕਿ ਪਹਿਲਾਂ ਇੱਕ ਬਹੁਤ ਬੜੇ ਬੜੇ ਕੈਮਰੇ ਹੁੰਦੇ ਸਨ ਬੜੇ ਬੜੇ ਕੈਮਰਿਆਂ ਦੇ ਵਿੱਚ ਬੰਦਾ ਫੋਟੋਆਂ ਖਿਚਾਉਂਦਾ ਹੁੰਦਾ ਸੀ ਅੱਜ ਕੱਲ੍ਹ ਉਹ ਕੈਮਰਾ ਆ ਚੁੱਕਿਆ ਹੈ ਜਿਹੜਾ ਕੋਈ ਵੀ ਬੰਦਾ ਆਪਣੇ ਹੱਥਾਂ ਦੇ ਵਿੱਚ ਚੱਕ ਕੇ ਆਪਣੇ ਕਿਸੇ ਦੀ ਵੀ ਫੋਟੋ ਕਲਿੱਕ ਕਰ ਸਕਦਾ ਹੈ ਅਗਰ ਫਿਰ ਆਪਾਂ ਟਕਨੋਲਜੀ ਦੀ ਤੀਜੀ ਗੱਲ ਕਰੀਏ ਪਹਿਲਾਂ ਕਿਸੇ ਟਾਇਮ ਹਰੇਕ ਬੰਦੇ ਕੋਲ ਸਾਈਕਲ ਹੁੰਦੇ ਸੀ ਜਦੋਂ ਹਰੇਕ ਬੰਦੇ ਕੋਲ ਸਾਈਕਲ ਹੁੰਦੇ ਸੀ ਬੰਦਾ ਸਾਈਕਲ ਦੇ ਵਿੱਚ ਆਉਣ ਜਾਣ ਆਪਣਾ ਸਫ਼ਰ ਤੈਅ ਕਰਦਾ ਹੁੰਦਾ ਸੀ ਬਟ ਅਗਰ ਆਪਾਂ ਉਸ ਟਕਨੋਲਜੀ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਸਾਈਕਲ ਤੋਂ ਫਿਰ ਆਹ ਹੁਣ ਮੋਟਰਸਾਈਕਲ ਆ ਚੁੱਕੇ ਹਨ ਹੁਣ ਬੰਦਾ ਜਿੱਥੇ ਵੀ ਜਾਂਦਾ ਹੈ ਇੱਕ ਸੈਲਫ਼ ਮਾਰਦਾ ਹੈ ਬੰਦਾ ਜਾ ਚ ਪਹੁੰਚਦਾ ਹੈ ਹੋਰ ਵੀ ਕਈ ਪ੍ਰਕਾਰ ਦੀਆਂ ਜਿੱਦਾਂ ਟਰਾਂਸਪੋਟੇਸ਼ਨ ਬੱਸਾਂ ਬੱਸਾਂ ਪਹਿਲਾਂ ਬਹੁਤ ਪਹਿਲਾਂ ਬਹੁਤ ਹੀ ਘੱਟ ਪ੍ਰਕਾਰ ਦੇ ਵਿੱਚ ਦੇਖਣ ਨੂੰ ਮਿਲਦੀਆਂ ਸਨ ਬਟ ਹੁਣ ਆਉਣ ਵਾਲੇ ਟਾਇਮ ਦੇ ਵਿੱਚ ਜਿੱਦਾਂ ਜਿੱਦਾਂ ਟਾਇਮ ਆਪਣਾ ਬਦਲਦਾ ਜਾ ਰਿਹਾ ਹੈੈ ਉਹ ਬੱਸਾਂ ਦਾ ਸਫ਼ਰ ਆਪਾਂ ਨੂੰ ਬਹੁਤ ਆਸਾਨ ਮਿਲਦਾ ਜਾ ਰਿਹਾ ਹੈ ਅਤੇ ਬੱਸਾਂ ਅੱਜ ਆਉਣ ਵਾਲੇ ਟਾਇਮ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਚੇਂਜ ਹੁੰਦੀਆਂ ਜਾ ਗਈਆਂ ਹਨ ਆਪਾਂ ਅੱਗੇ ਗੱਲ ਕਰਾਂਗੇ ਪਹਿਲਾਂ ਟਰੇਨ ਦੀ ਪਹਿਲਾਂ ਟਰੇਨ ਹੁੰਦੀ ਸੀ ਨੋਰਮਲ ਇੰਜਣ ਦੇ ਡੱਬੇ ਵਾਲੀ ਕੋਲਿਆਂ ਵਾਲੀ ਟਰੇਨ ਹੁਣ ਅੱਜ ਦੇ ਟਾਇਮ ਦੇ ਵਿੱਚ ਟਾਇਮ ਬਦਲਣ ਦੇ ਨਾਲ ਹੁਣ ਮੈਟਰੋ ਟਰੇਨਾਂ ਆ ਚੁੱਕੀਆਂ ਹਨ ਜਿਹੜੀ ਤੁਹਾਨੂੰ ਕੁਝ ਹੀ ਸਕਿੰਟਾਂ ਵਿੱਚ ਤੁਹਾਡਾ ਸਫ਼ਰ ਕਿੱਥੇ ਤੋਂ ਕਿੱਥੇ ਪਹੁੰਚਾ ਦਿੰਦੀਆਂ ਹਨ